ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਮੈਂ ਤੁਹਾਡੇ ਸਾਰਿਆਂ ਦੇ ਨਾਲ ਐਸ ਵੇਲੇ ਗੱਲ ਕਰਨ ਜਾ ਰਿਹਾ ਵਾਂ ਪੀ ਪੰਜਾਬ ਵਿੱਚ ਖੇਤੀਬਾੜੀ ਸੈਕਟਰ ਦਾ ਉਹਦਾ ਕੀ ਮਹੱਤਤਾ ਵਾ ਉਹਦਾ ਕੀ ਯੋਗਦਾਨ ਵਾ ਜਿਹੜਾ ਵਾ ਸਾਡੇ ਨਿੱਜੀ ਜੀਵਨ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕੀ ਉਹਦਾ ਯੋਗਦਾਨ ਵਾ ਜਿਹਦੇ ਜਿਹਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਪੀ ਪੰਜਾਬ ਦੇ ਵਿੱਚ ਜਿਹੜਾ ਵਾ ਖੇਤੀਬਾੜੀ ਦਾ ਵੇਖਿਆ ਜਾਏ ਤਾਂ ਸ਼ੁਰੂ ਤੋਂ ਹੀ ਬਹੁਤ ਹੀ ਜ਼ਿਆਦਾ ਮਹੱਤਵ ਜਿਹੜਾ ਵਾ ਉਹ ਰਿਹਾ ਵਾ ਪੰਜਾਬ ਦੇ ਲੋਕ ਸ਼ੁਰੂ ਸ਼ੁਰੂ ਵਿੱਚ ਸੱਠ ਪਰਸੈਂਟ ਤੱਕ ਜਿਹੜੀ ਆਬਾਦੀ ਜਿਹੜੀ ਹੈ ਉਹ ਐਗਰੀਕਲਚਰ ਦੇ ਨਾਲ ਜਿਹੜੀ ਹੈ ਉਹ ਉਹਦੇ 'ਤੇ ਡਿਪੈਂਡ ਸੀਗੀ ਪਰ ਹੁਣ ਜਿਹੜਾ ਵਾ ਰੁਝਾਨ ਜਿਹੜਾ ਐਗਰੀਕਲਚਰ ਦਾ ਥੋੜ੍ਹਾ ਜਿਹਾ ਅੱਗੇ ਨਾਲੋਂ ਜਿਹੜਾ ਵਾ ਉਹ ਘਟਿਆ ਵਾ ਪਰ ਇਹਦੀ ਜਿਹੜੀ ਹੈ ਇ ਰੁਝਾਨ ਜਿਹੜਾ ਇਹਦਾ ਘੱਟਣ ਤੋਂ ਬਾਦ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਖੇਤੀਬਾੜੀ ਆ ਇਹਦਾ ਜਿਹੜਾ ਵਾ ਇਹਦੀ ਕੋਈ ਮਹੱਤਤਾ ਜਿਹੜੀ ਹੈ ਉਹ ਰਹੀ ਨਹੀਂ ਇਹ ਗੱਲ ਨਹੀਂ ਕਹਿ ਸਕਦੇ ਅਸੀਂ ਖੇਤੀਬਾੜੀ ਨੇ ਸਾਡੇ ਜ਼ਿੰਦਗੀ ਦੇ ਵਿੱਚ ਲੱਖਾਂ ਹੀ ਲੋਕਾਂ ਨੂੰ ਕਰੋੜਾਂ ਹੀ ਲੋਕਾਂ ਨੂੰ ਜਿਹੜਾ ਵਾ ਉਹ ਰੁਜ਼ਗਾਰ ਦਿੱਤਾ ਵਾ ਜਦੋਂ ਅਸੀਂ ਗੋਡੀ ਕਰਨੀ ਹੁੰਦੀ ਆ ਜਾਂ ਆਪਾਂ ਕੋਈ ਕਣਕ ਦੀ ਪਟਾਈ ਕਰਨੀ ਹੈ ਜਾਂ ਕੁਛ ਕਰਨਾ ਵਾ ਜੋ ਵੀ ਕਰਨਾ ਵਾ ਅਸੀਂ ਸਾਡੇ ਵਾਸਤੇ ਸਾਨੂੰ ਜਿਹੜੀ ਆ ਉਹ ਲੇਬਰ ਦੀ ਲੋੜ ਪੈਂਦੀ ਆ ਲੇਬਰ ਨੇ ਜਦੋਂ ਲੋੜ ਪੈਂਦੀ ਆ ਅਤੇ ਉਹਦੇ ਨਾਲ ਜਿਹੜੀ ਸਾਡੀ ਜਿਹੜੀ ਆ ਉਹ ਸਿੱਧੇ ਤੌਰ 'ਤੇ ਜਿਹੜੀਆਂ ਵਾ ਇਹ ਲੋਕਾਂ ਨੂੰ ਜਿਹੜਾ ਵਾ ਉਹ ਇੱਕ ਰੁਜ਼ਗਾਰ ਜਿਹੜਾ ਵਾ ਉਹ ਮਿਲਦਾ ਵਾ ਖੇਤੀਬਾੜੀ ਦੇ ਨਾਲ ਇੱਕ ਤਾਂ ਰੁਜ਼ਗਾਰ ਮਿਲਦਾ ਵਾ ਰੁਜ਼ਗਾਰ ਦੇ ਨਾਲ ਦੇ ਨਾਲ ਜਿਹੜਾ ਵਾ ਸਾਡੀ ਜਿਹੜਾ ਵਾ ਉਹ ਸਾਨੂੰ ਇੱਕ ਕੁਝ ਖਾਣ ਦਾ ਜਿਹੜਾ ਵਾ ਉਹ ਕਈ ਵੱਖ ਵੱਖ ਚੀਜ਼ਾਂ ਜਿਹੜੀਆਂ ਵਾ ਖੇਤੀਬਾੜੀ ਤੋਂ ਸਾਨੂੰ ਜਿਹੜੀਆਂ ਵਾ ਮਿਲਦੀਆਂ ਹੈ ਜਿਹਦੇ ਵਿੱਚ ਕਈ ਤਰ੍ਹਾਂ ਦਾਲਾਂ ਵਾ ਜਿਹੜੀਆਂ ਚੌਲ ਵਾ ਕਣਕ ਵਾ ਜਵਾਰ ਦੀ ਕਣਕ ਜਵਾਰ ਦੀ ਜਿਹੜੀ ਆ ਰੋਟੀ ਖਾਂਦੇ ਹਾਂ ਅਸੀਂ ਉਹ ਦੇਖੋ ਸਾਰੇ ਇੱਕ ਚੀਜ਼ ਜਿਹੜੀ ਆ ਉਹ ਐਗਰੀਕਲਚਰ ਦੇ ਨਾਲ ਜਿਹੜੀ ਆ ਉਹ ਜੁੜੀ ਹੋਈ ਆ ਸਾਡਾ ਜਿਹੜਾ ਭੋਜਨ ਜਿਹੜਾ ਵਾ ਉਹ ਡਰੈਕਟਲੀ ਤਾਂ ਨਹੀਂ ਚਲੋ ਇੰਡਰੈਕਟਲੀ ਤਾਂ ਆ ਪ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਰ ਇੱਕ ਬੰਦਾ ਮੇਰੇ ਹਿਸਾਬ ਨਾਲ ਤਾਂ ਆਪਾਂ ਐਗਰੀਕਲਚਰ ਦੇ ਨਾਲ ਜਿਹੜਾ ਵਾ ਉਹ ਰਿਲੇਟ ਕਰਦਾ ਵਾ ਹਰ ਇੱਕ ਬੰਦਾ ਜਿਹੜਾ ਵਾ ਐਗਰੀਕਲਚਰ ਦੇ ਉੱਤੇ ਡਿਪੈਂਡ ਹੀ ਹੈਗਾ ਵਾ ਅਤੇ ਇਸਦੀ ਜਿਹੜੀ ਮਹੱਤਤਾ ਜਿਹੜੇ ਸਾਡੇ ਜੀਵਨ ਦੇ ਵਿੱਚ ਜਿਹੜਾ ਵਾ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ